ਗੱਤਕਾ ਇੱਕ ਮਨੋਰੰਜਨ ਗਤੀਵਿਧੀ ਦੇ ਨਾਲ ਨਾਲ ਇੱਕ ਪ੍ਰਸਿੱਧ ਖੇਡ ਵੀ ਹੈ ਜੋ ਰੂਪਨਗਰ ਜ਼ਿਲ੍ਹੇ ਵਿੱਚ ਪ੍ਰਸਿੱਧ ਹੈ ਇਹ ਗਤੀਵਿਧੀ ਲੋਕਾਂ ਨੂੰ ਇਕੱਠੇ ਕਰਨ ਲਈ ਵੀ ਹੁੰਦੀ ਹੈ ਇਸਦੇ ਨਾਲ ਨਾਲ ਭਾਈਚਾਰੇ ਦੀ ਭਾਵਨਾ ਦੀ ਯੋਗਦਾਨ ਵੀ ਲੋਕ ਪਾਉਂਦੇ ਹਨ